ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਪ੍ਰੀਤੀ ਬੋਲ ਰਹੀ ਹਾਂ ਕੱਲ੍ਹ ਦਸ ਦਿਨ ਪਹਿਲਾਂ ਹੀ ਮੇਰਾ ਡਿਸਚਾਰਜ ਹੋਇਆ ਸੀ

ਜੀ ਮੇਰਾ ਪਰਚੀ ਨੰਬਰ ਚੌਵੀ ਹੈ ਹਾਂਜੀ ਹਾਂਜੀ ਹਾਂਜੀ ਮੈਮ ਮੈਂ ਨਾ ਉਹ ਵੈਸੇ ਤਾਂ ਕੱਲ੍ਹ ਚੈੱਕਅਪ ਲਈ ਆਈ ਸੀ ਬਟ ਮੈਂ ਉਹ ਪੁੱਛਣਾ ਭੁੱਲ ਗਈ ਕਿ ਮੇਰਾ ਜਿਹੜੀ ਖਾਣ ਵਾਲੀਆਂ ਚੀਜ਼ਾਂ ਦੀ ਮਨਾਹੀ ਸੀ ਹੁਣ ਉਹ ਮੈਂ ਖਾ ਸਕਦੀ ਹਾਂ ਕਿ ਨਹੀਂ ਹਾਂਜੀ ਮੈਮ

ਹਾਂਜੀ ਮੈਮ ਹਾਂਜੀ ਮੈਮ ਠੀਕ ਹੈ ਅਤੇ ਮੈਮ ਮੈਂ ਦੁੱਧ ਲੈ ਸਕਦੀ ਹਾਂ ਹੁਣ ਕੇ ਨਹੀਂ ਅੱਛਾ ਮੈਮ ਅਤੇ ਦਹੀਂ ਦਹੀਂ ਲੱਸੀ ਠੀਕ ਹੈ ਮੈਮ ਅਤੇ ਮੈਮ ਉਹ ਮੇਰੇ ਟਾਂਕੇ ਕਦੋਂ ਖੁਲਣੇ ਹੈ ਹਾਂਜੀ ਠੀਕ ਹੈ ਮੈਮ ਹਾਂਜੀ ਠੀਕ ਹੈ ਮੈਮ ਹੋਰ ਕੋਈ ਪਰਹੇਜ਼ ਵਗੈਰਾ ਠੀਕ ਹੈ ਮੈਮ

ਓਕੇ ਥੈਂਕ ਯੂ ਧੰਨਵਾਦ ਮੈਮ ਸਤਿ ਸ਼੍ਰੀ ਅਕਾਲ